ਹਾਂਜੀ ਮੇਰੀ ਰੋਜ਼ੀ ਰੋਟੀ ਬਿਜਲੀ 'ਤੇ ਹੀ ਨਿਰਭਰ ਕਰਦੀ ਹੈ ਜਦੋਂ ਮੈਂ ਕੰਪਿਊਟਰ ਚਲਾਉਂਦੀ ਹਾਂ ਜਾਂ ਮੈਂ ਜਿਹੜਾ ਆਪਣਾ ਆਪਣਾ ਕੰਮ ਕਰਦੀ ਹਾਂ ਅਤੇ ਉਹ ਬਿਜਲੀ ਨਹੀਂ ਹੋਏਗੀ ਤਾਂ ਉਹ ਕਿੱਥੋਂ ਚੱਲੇਗਾ ਬਿਜਲੀ ਦੇ ਜਿਸ ਦਿਨ ਕੱਟ ਲੱਗ ਜਾਂਦਾ ਉਸ ਦਿਨ ਮੇਰਾ ਸਾਰਾ ਕੰਮ ਰਹਿ ਜਾਂਦਾ ਸਾਰਾ ਮੇਰਾ ਅਕਾਊਂਟਸ ਦਾ ਕੰਮ ਰਹਿ ਜਾਂਦਾ ਬਿਜਲੀ ਦੇ ਨਾਲ ਹੀ ਦੇਖੋ ਅਸੀਂ ਰੋਟੀ ਘਰ ਦੇ ਕੰਮ ਕਰਨੇ ਬੱਤੀ ਨਹੀਂ ਹੋਏਗੀ ਲਾਈਟ ਨਹੀਂ ਹੋਏਗੀ ਬਿਜਲੀ ਨਹੀਂ ਹੋਏਗੀ ਅਤੇ ਰੋਸ਼ਨੀ ਨਹੀਂ ਹੋਏਗੀ ਘਰ ਦੇ ਬਾਕੀ ਕੰਮ ਕਿਸ ਤਰ੍ਹਾਂ ਹੋਣਗੇ ਬਿਜਲੀ ਦੇ ਦੌਰਾਨ ਦੇਖੋ ਬਿਜਲੀ ਦੇ ਸਾਰੇ ਕੰਮ ਹੀ ਬਿਜਲੀ ਦੇ ਉਤੇ ਡਿਪੈਂਡ ਕਰਦੇ ਹਨ ਬਿਜਲੀ ਨਹੀਂ ਹੋਏਗੀ ਅਸੀਂ ਘਰ ਦੇ ਕੰਮ ਮੋਟਰ ਕਿੱਥੋਂ ਛੱਡਾਂਗੇ ਪਾਣੀ ਕਿੱਥੋਂ ਭਰਾਂਗੇ ਰੋਸ਼ਨੀ ਨਹੀਂ ਹੋਏਗੀ ਬੱਚੇ ਕਿੱਥੋਂ ਪੜਾਵਾਂਗੇ ਜੀ ਅੰਦਰ ਬੱਚਿਆਂ ਨੇ ਰਾਤੀ ਆਉਣਾ ਸ਼ਾਮੀ ਸਕੂਲੋਂ ਟਿਊਸ਼ਨ ਟਾਊਸ਼ਨ ਪੜ੍ਹ ਕੇ ਆਪਣੀਆਂ ਜਦੋਂ ਉਹਨਾਂ ਨੇ ਆਉਣਾ ਅਤੇ ਜਦੋ ਅਸੀਂ ਵੀ ਸ਼ਾਮ ਨੂੰ ਘਰ ਜਾਣਾ ਅਤੇ ਪੜ੍ਹਾਉਣਾ ਅਤੇ ਅਸੀਂ ਉਹਨਾਂ ਨੂੰ ਰਾਤ ਨੂੰ ਹੀ ਹੈ ਅਤੇ ਰਾਤੀ ਬੱਤੀ ਨਹੀਂ ਹੋਏਗੀ ਲਾਈਟ ਨਹੀਂ ਹੋਏਗੀ ਤਾਂ ਅਸੀਂ ਉਹਨਾਂ ਨੂੰ ਕਿੱਥੋਂ ਪੜ੍ਹਾਵਾਂਗੇ ਹਾਂ ਇਸ ਗੱਲ ਸਾਡੇ ਅੰਬਰਸਰ ਦੇ ਵਿੱਚ ਬਹੁਤ ਸਾਰੇ ਲੋਕਾਂ ਕੋਲ ਇਨਵਰਟਰ ਹੈਗੇ ਹਨ ਪਰ ਜੇ ਦੇਖੋ ਜੇ ਜਿਨ੍ਹਾਂ ਕੋਲ ਇਨਵਰਟਰ ਨਹੀਂ ਹੈਗੇ ਉਹਨਾਂ ਦਾ ਜੀਵਨ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ ਨਾ ਬਿਨਾਂ ਬਿਜਲੀ ਤੋਂ ਬਿਜਲੀ ਨਹੀਂ ਹੋਏਗੀ ਦੇਖੋ ਸਾਡਾ ਬਾਕੀ ਔਫਿਸ ਵਗੈਰਾ ਦਾ ਕੰਮ ਤਾਂ ਰਿਹਾ ਹੀ ਰਿਹਾ ਅਤੇ ਘਰਾਂ ਦੇ ਵੀ ਕਿੰਨੇ ਕੰਮ ਖਰਾਬ ਹੋ ਗਏ ਬੱਚੇ ਰਹਿ ਗਏ ਪਾਣੀ ਨਹੀਂ ਹੋਏਗਾ ਬੱਤੀ ਨਹੀਂ ਹੋਏਗੀ ਤਾਂ ਅਸੀਂ ਮੋਟਰ ਕਿੱਥੋਂ ਛੱਡਾਂਗੇ ਮੋਟਰ ਨਹੀਓਂ ਛੱਡਾਂਗੇ ਤਾਂ ਪਾਣੀ ਕਿੱਥੋਂ ਭਰਾਂਗੇ ਪਾਣੀ ਨਹੀਂ ਹੋਏਗਾ ਤਾਂ ਬੱਚੇ ਸਵੇਰੇ ਨਹਾ ਕੇ ਕਿੱਥੋਂ ਜਾਣਗੇ ਜੀ ਸਕੂਲ ਜੇ ਉਹ ਨਹਾਉਣਗੇ ਨਹੀਂ ਤਾਂ ਉਹਨਾਂ ਦੀ ਪੜ੍ਹਾਈ ਖਰਾਬ ਹੋਏਗੀ ਦੇਖੋ ਉਹਦੇ ਨਾਲ ਬਿਜਲੀ ਦੇ ਨਾਲ ਸਾਰਾ ਦਾ ਸਾਰਾ ਜਿਹੜਾ ਸਿਸਟਮ ਹੈ ਬਿਲਕੁਲ ਹੀ ਤਰ੍ਹਾਂ ਖਰਾਬ ਹੋ ਜਾਂਦਾ